ਅੰਮ੍ਰਿਤਸਰ ਸ਼ਹਿਰ ਵਿੱਚ ਚੈਰਟੀ ਜਾਂ ਭਾਈਚਾਰਕ ਸੰਸਥਾਵਾਂ ਹਨ ਕੁਛ ਜਿਹੜੀਆਂ ਕਿ ਲੋਕ ਭਲਾਈ ਵਾਸਤੇ ਬਣਾਈਆਂ ਗਈਆਂ ਹਨ ਜਿਵੇਂ ਕਿ ਗੁਰੂ ਰਾਮਦਾਸ ਦੇ ਬਿਰਧ ਘਰ ਬਣਿਆ ਹੋਇਆ ਇੱਕ ਅਤੇ ਇੱਕ ਹੈਗਾ ਜੀ ਪੂਰਨ ਸਿੰਘ ਜਿਹੜਾ ਪਿੰਗਲਵਾੜਾ ਹੈ ਇੱਥੇ ਜਿਹੜੀਆਂ ਬੇਸਹਾਰਿਆਂ ਦੀਆਂ ਫੈਸਿਲਟੀਆਂ ਹਨ ਬੁਢਾਪਿਆ ਵਾਸਤੇ ਜਾਂ ਹੋਰ ਪਿੰਗਲਵਾੜੇ ਵਿੱਚ ਕਈ ਬੱਚੇ ਵੀ ਬੇਸਹਾਰਾ ਨੂੰ ਫਸਿਲਟੀਆਂ ਦਿੱਤੀਆਂ ਜਾਂਦੀਆਂ ਉਹ ਸਥਾਨਕ ਲੋਕ ਜਾ ਕੇ ਉੱਥੇ ਤਰ੍ਹਾਂ ਤਰ੍ਹਾਂ ਨਾ ਮਦਦ ਵੀ ਕਰਦੇ ਹੈ ਕੁਛ ਤਾਂ ਪੱਕੇ ਤੌਰ 'ਤੇ ਆਪਣੀ ਕੋਈ ਨਾ ਕੋਈ ਦਾਨ ਉੱਥੇ ਦਿੰਦੇ ਹੈ ਔਰ ਕੁਝ ਪਰਿਵਾਰ ਜਿਸ ਤਰ੍ਹਾਂ ਹੁਣ ਸਮੇਂ ਸਮੇਂ 'ਤੇ ਗਏ ਜਦੋਂ ਉਹਨਾਂ ਦੇ ਪੁੰਨ ਕਰਨ ਦਾ ਕੋਈ ਵਿਚਾਰ ਹੁੰਦਾ ਤਾਂ ਆਪਣੇ ਕੋਈ ਕੱਪੜੇ ਜਾਂ ਕੋਈ ਕਦੇ ਕਦਾਈ ਵੀ ਦੇ ਆਉਂਦੇ ਕੋਈ ਫਾਈਨੈਂਸ਼ਅਲ ਉੱਥੇ ਸਹਾਇਤਾ ਦੇ ਆਉਂਦੇ ਹੈ ਅਤੇ ਭਾਈ ਘਨੱਈਆ ਜੀ ਬਿਰਧ ਘਰ ਪਿੰਗਲਵਾੜਾ ਹੋ ਗਿਆ ਬਾਕੀ ਬੇਘਰ ਪਰਿਵਾਰਾਂ ਦੀ ਗਿਣਤੀ ਤਾਂ ਇਸ ਤਰ੍ਹਾਂ ਨਾਲ ਵੱਧ ਰਹੀ ਹੈ ਕਿਉਂਕਿ ਜਨਸੰਖਿਆ ਤਾਂ ਵੱਧ ਰਹੀ ਹੈ ਇਸ ਦੇ ਨਾਲ ਨਾਲ ਨਾ ਪਰਿਵਾਰਾਂ 'ਚ ਥੋੜ੍ਹੇ ਪਾੜੇ ਵੱਧ ਰਹੇ ਆ ਅਤੇ ਹੁਣ ਜਦੋਂ ਘਰਾਂ ਵਿੱਚ ਇੱਕ ਪਾਟੀਸ਼ਨ ਹੀ ਆਪਸ 'ਚ ਵੱਖਰਾ ਬਣ ਆਉਂਦਾ ਹੈ ਅਤੇ ਉਹਦੀ ਕਿਰਾਏ 'ਤੇ ਘਰਾਂ 'ਤੇ ਜਾ ਜਾ ਕੇ ਲੋਕ ਰਹਿੰਦੇ ਆ ਮਿਲ ਜੁਲ ਕੇ ਇੱਕ ਬੜਾ ਘਰ ਵਿੱਚ ਰਹਿ ਸਕਦੇ ਆ ਉਹ ਹੁਣ ਭਾਵਨਾਵਾਂ ਖ਼ਤਮ ਹੋਣ ਕਰਕੇ ਉਹਦਾ ਸਿੱਟਾ ਭੁਗਤਣਾ ਪੈ ਰਿਹਾ ਸਾਰੀ ਦੁਨੀਆ ਨੂੰ ਇਹ ਸਭ ਜਗ੍ਹਾ ਦੇਖਣ 'ਚ ਮਾਹੌਲ ਆਇਆ ਰਿਹਾ ਹੈ